ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬੋਲੋ ਜੀ ਮੈਂ ਕਲੋਜ ਬੈਂਕ ਆਫਿਸ ਤੋਂ ਬੋਲ ਰਿਹਾ ਜੀ ਹਾਂਜੀ ਅੱਛਾ ਜੀ ਤੁਹਾਡੀ ਕੀ ਕੁਆਲ ਕੁਆਲੀਫਿਕੇਸ਼ਨ ਕੀ ਹੈ ਜੀ ਤੁਹਾਡੀ ਅੱਛਾ ਜੀ ਤ ਤੁਹਾਨੂੰ ਸਾਡਾ ਔਫਿਸ ਪਤਾ ਕਿੱਥੇ ਹੈ ਜੀ ਸਾਡਾ ਲਾਡਰਾਂ ਰੋਡ 'ਤੇ ਔਫਿਸ ਹੈ ਜੀ ਤੁਸੀਂ ਵਿਜ਼ੀਟ ਕਰੋ ਉੱਥੇ ਔਫਿਸ 'ਚ ਆ ਕੇ ਆਪਾਂ ਡਿਸਕਸ ਕਰਦੇ ਹਾਂ ਜੀ ਬਹਿ ਕੇ ਫਿਰ ਤੁਹਾਨੂੰ ਕਿਸ ਕਿਸ ਤਰ੍ਹਾਂ ਜੋਬ ਮਿਲ ਸਕਦੀ ਹੈ ਔਫਿਸ ਦੀ ਤੁਸੀਂ ਟੈਨ ਦਸ ਵਜੇ ਆ ਜਿਉ ਜੀ ਦਸ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਖੁੱਲ੍ਹਾ ਹੁੰਦਾ ਹੈ ਜੀ ਔਫਿਸ ਹਾਂਜੀ ਨਹੀਂ ਮੈਂ ਉੱਥੇ ਹੁੰਦਾ ਜੀ ਮੈਂ ਦਸ ਵਜੇ ਪਹੁੰਚ ਜਾਂਦਾ ਜੀ ਉੱਥੇ ਹਾਂਜੀ ਹਾਂਜੀ ਹਾਂਜੀ ਤੁਸੀਂ ਸਾਡੇ ਔਫਿਸ ਵਿਜ਼ੀਟ ਕਰੋ ਫਿਰ ਉੱਥੇ ਡਿਸਕਸ ਪ ਪਤਾ ਲੱਗ ਜੂਗਾ ਫਿਰ ਤੁਹਾਨੂੰ ਜੋਬ ਦੇਵਾ ਦਾਗੇ ਜੀ ਹਾਂਜੀ ਵੈਸੇ ਵੈਸੇ ਤਾਂ ਇੱਥੇ ਵੈਕੈਸੀਆਂ ਘੱਟ ਹੈ ਪਰ ਅਸੀਂ ਫਿਰ ਵੀ ਟ੍ਰਾਈ ਕਰ ਲਵਾਂਗੇ ਜੀ ਤੁਸੀਂ ਆ ਜਿਓ ਜੀ ਅਸੀਂ ਆਪਾਂ ਬੈਠ ਕੇ ਡਿਸਕਸ ਕਰ ਲਵਾਂਗੇ ਜੀ ਠੀਕ ਹੈ ਜੀ ਥੈਂਕ ਯੂ